ਜਨਮੇ ਬੱਚਿਆਂ ਨੂੰ ਇੱਕ ਸਵੱਛ ਵਾਤਾਵਰਣ ਦੇ ਨਾਲ ਸਾਡਾ ਇੱਕ ਬਹੁਤ ਵੱਡਾ ਕੰਮ ਹੈ ਇਹ ਅਸੀ ਬੜੇ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਜਿਹਦੇ ਸਿਹਤਮੰਦ ਪੋਸ਼ਣ ਮਾਂ ਦਾ ਦੁੱਧ ਬੱਚਿਆਂ ਲਈ ਸਭ ਤੋਂ ਵਧੀਆ ਆਹਾਰ ਹੁੰਦਾ ਹੈ ਇਹ ਉਹਨਾਂ ਨੂੰ ਉਹਨਾਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਂਦਾ ਹੈ ਅਤੇ ਸਹੀ ਵਿਕਾਸ ਵਿੱਚ ਮਦਦ ਕਰਦਾ ਹੈ ਸਫਾਈ ਅਤੇ ਹਾਈਜੀਨ ਬੱਚਿਆਂ ਦੀ ਸਫਾਈ ਰੱਖਣੀ ਬਹੁਤ ਜ਼ਰੂਰੀ ਹੈ ਹੱਥ ਧੋਣਾ ਚੰਗਾ ਪਾਣੀ ਪਾਲਣਾ ਅਤੇ ਗੰਦਗੀ ਤੋਂ ਬਚਾਅ ਕਰਨਾ ਬਿਮਾਰੀਆਂ ਤੋਂ ਬਚਾਉਂਦਾ ਹੈ ਟੀਕਾਕਰਣ ਵੀ ਬਹੁਤ ਅਹਿਮ ਵਰਤੋਂ ਕਰਦਾ ਹੈ ਸਮੇਂ ਸਮੇਂ 'ਤੇ ਲੱਗਣ ਵਾਲੇ ਟੀਕਿਆਂ ਬੱਚਿਆਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਉਂਦੇ ਹਨ ਮਾਨਸਿਕ ਅਤੇ ਮਾਨਸਿਕ ਅਤੇ ਜਿਸਮਾਨੀ ਵਿਕਾਸ ਬੱਚਿਆਂ ਨਾਲ ਖੇਡਣਾ ਉਹਨਾਂ ਨਾਲ ਗੱਲਬਾਤ ਕਰਨੀਆਂ ਅਤੇ ਉਹਨਾਂ ਨੂੰ ਪਿਆਰ ਮਿਲਣਾ ਉਹਨਾਂ ਨੂੰ ਮਾਨਸਿਕ ਵਾਧੂ ਮਦਦ ਕਰਦਾ ਹੈ ਵਾਤਾਵਰਣ ਅਤੇ ਸੁਰੱਖਿਆ ਬੱਚਿਆਂ ਨੂੰ ਸੁਰੱਖਿਅਤ ਅਤੇ ਪਿਆਰ ਭਰੇ ਵਾਤਾਵਰਣ ਵਿੱਚ ਰੱਖਣਾ ਉਹਨਾਂ ਦੀ ਆਤਮ ਵਿਸ਼ਵਾਸ ਵਧਾਉਂਦਾ ਹੈ ਧੰਨਵਾਦ